ਭਾਰਤ ਵਿੱਚ ਬਹੁਤ ਹੀ ਮਸ਼ਹੂਰ ਨਾਚ ਹਨ ਪਰ ਭੰਗੜਾ ਗਿੱਧਾ ਕਿੱਕਲੀ ਝੂੰਮਰ ਲੂੱਡੀ ਇਹ ਸਾਰੇ ਸਭ ਤੋਂ ਵਧੀਆ ਅਤੇ ਖੁਸ਼ਹਾਲ ਜੀਵਨ ਵਾਸਤੇ ਵਰਤੇ ਜਾਂਦੇ ਹਨ ਸਾਡੇ ਅੱਜ ਕੇ ਅੱਜ ਕੱਲ੍ਹ ਦੇ ਨੌਜਵਾਨ ਭੰਗੜਾ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਮੈਨੂੰ ਵੀ ਭੰਗੜਾ ਪਾਉਣਾ ਬਹੁਤ ਪਸੰਦ ਹੈ ਮੇਰੇ ਘਰ ਵਿੱਚ ਜਦੋਂ ਵੀ ਕੋਈ ਵਿਆਹ ਸ਼ਾਦੀ ਕੋਈ ਤਿਉਹਾਰ ਜਾਂ ਕੁਝ ਵੀ ਆਉਂਦਾ ਹੈ ਤਾਂ ਅਸੀਂ ਸਾਰੇ ਜਾਣੇ ਮਿਲ ਕੇ ਭੰਗੜਾ ਕਰਦੇ ਹਨ ਸਾਡੇ ਅੱਜ ਕੱਲ੍ਹ ਕੋਲਜਾਂ ਸਕੂਲਾਂ ਵਿੱਚ ਵੀ ਭੰਗੜੇ ਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਭੰਗੜਾ ਲੋਕਾਂ ਲੋਕਾਂ ਦੇ ਅੰਦਰੂਨੀ ਅਤੇ ਲੋਕਾਂ ਦੇ ਮਾਨਸਿਕ ਸੰਤੁਲਨ ਨੂੰ ਵੀ ਬਹੁਤ ਜ਼ਿਆਦਾ ਵਧੀਆ ਰੱਖਦਾ ਹੈ ਭੰਗੜਾ ਕਰਨ ਨਾਲ ਆਪਾਂ ਬਹੁਤ ਆਪਾਂ ਬਹੁਤ ਜ਼ਿਆਦਾ ਆਪਾਂ ਬਹੁਤ ਜ਼ਿਆਦਾ ਭੰਗੜਾ ਇੱਕ ਦੂਜੇ ਨਾਲ ਨੇੜਤਾ ਵਧਾਉਂਦਾ ਹੈ ਆਪਾਂ ਆਪਣੇ ਆਢੀਆਂ ਗੁਆਂਡੀਆਂ ਨਾਲ ਮਿਲ ਕੇ ਭੰਗੜਾ ਪਾਉਂਦੇ ਹਾਂ ਆਪ ਆਪਣੇ ਦੋਸਤਾਂ ਨਾਲ ਅੱਜ ਕੱਲ੍ਹ ਦੀਆਂ ਮੁਟਿਆਰਾਂ ਇਕੱਠੀਆਂ ਹੋ ਕੇ ਤਿਆਰ ਹੋ ਕੇ ਭੰਗੜਾ ਪਾਉਂਦੀਆਂ ਹਨ ਅਤੇ ਗਿੱਧਾ ਪਾਉਂਦੀਆਂ ਹਨ ਜਿਹਦੇ ਨਾਲ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਅਤੇ ਆਪਾਂ ਨੂੰ ਵੀ ਬਹੁਤ ਦੇਖਣ ਵਾਲੇ ਨੂੰ ਵੀ ਬੜਾ ਹੀ ਜ਼ਿਆਦਾ ਅਤੇ ਅੱਖ ਅੱਖਾਂ ਖਿਚਾਓ ਵਾਲਾ ਲੱਗਦਾ ਹੈ ਜਿਵੇਂ ਕਿ ਭੰਗੜਾ ਅੱਜ ਕੱਲ੍ਹ ਕੋਲਜਾਂ ਵਿੱਚ ਵੀ ਬੜਾ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ ਹੈ ਮੈਨੂੰ ਵੀ ਭੰਗੜਾ ਬਹੁਤ ਪਸੰਦ ਹੈ ਮੈਂ ਹਮੇਸ਼ਾ ਵੀ ਜਦੋਂ ਵੀ ਮਤਲਬ ਕੋਈ ਖੁਸ਼ੀ ਦਾ ਤਿਉਹਾਰ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਹੈ ਤਾਂ ਮੈਂ ਬਹੁਤ ਜ਼ਿਆਦਾ ਗਿੱਧਾ ਪਾਉਂਦੀ ਹਾਂ ਆਪਣੇ ਫਰੈਂਡਸ ਦੇ ਨਾਲ ਮਿਲ ਕੇ